ਹੈਲੋ ਸਤਿ ਸ਼੍ਰੀ ਅਕਾਲ ਬਾਈ ਬਰਾਡ ਰੈਸਟੋਡੈਂਟ ਤੋਂ ਬੋਲਦੇ ਹੋ ਬਈ ਬਈ ਮੈਂ ਪਿੰਡ ਬੱਲੂ ਆਂਨੇ ਤੋਂ ਬੋਲਦੀ ਹਾਂ ਬਈ ਮੇਰੀ ਫਰੈਂਡ ਦਾ ਨਾ ਬਡੇ ਆ ਅਸੀਂ ਰੈਸਟੋਡੈਂਟ ਵਿੱਚ ਨਾ ਇੱਕ ਬਡੇ ਪਾਰਟੀ ਕਰਨੀ ਆ ਜਿਸ ਵਿੱਚ ਅਸੀਂ ਇੱਕ ਟੇਬਲ ਬੁੱਕ ਕਰਾਉਣਾ ਘੱਟੋ ਘੱਟ ਦੱਸ ਬਾਰ੍ਹਾਂ ਜਣੇ ਹੋਣਗੇ ਅਸੀਂ ਅਤੇ ਸਾਨੂੰ ਇੱਕ ਟੇਬਲ ਫਰੀ ਆ ਜਿਹੜਾ ਸਾਨੂੰ ਬੁੱਕ ਅਸੀਂ ਬੁੱਕ ਕਰਾ ਸਕਦੇ ਹਾਂ ਬਈ ਮੈਂ ਪ ਅਸੀਂ ਪਹਿਲੀ ਵਾਰੀ ਟੇਬਲ ਬੁੱਕ ਕਰਾਉਣ ਲੱਗੇ ਹਾਂ ਤਾਂ ਕਰਕੇ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਟੇਬਲ ਵਿੱਚ ਕਿਨ ਟੇਬਲ ਬੁੱਕ ਕਰਾਉਣ 'ਤੇ ਸਾਨੂੰ ਕਿੰਨਾ ਕੁ ਖਰਚਾ ਆ ਸਕਦਾ ਅਤੇ ਬਾਈ ਜੇ ਅਸੀਂ ਰੈਸਟੋਡੈਂਟ ਦੇ ਵਿੱਚੋਂ ਹੀ ਸਾਰਾ ਸਮਾਨ ਲੈਣਾ ਹੈਗਾ ਅਤੇ ਤੁਸੀਂ ਮੈਨੂੰ ਇਹ ਵੀ ਦੱਸ ਸਕਦੇ ਹੋ ਕਿ ਜਦੋਂ ਅਸੀਂ ਰੈਸਟੋਡੈਂਟ ਵਿੱਚ ਟੇਬਲ ਬੁੱਕ ਕਰਾ ਕੇ ਸਮਾਨ ਖਰੀਦ ਦੇ ਹਾਂ ਤਾਂ ਜਿਵੇਂ ਬਰਗਰ ਜਾਂ ਸਮੋਸੇ ਜਾਂ ਕੁਲਚੇ ਲੈਂਦੇ ਹਾਂ ਪੰਦਰ੍ਹਾਂ ਵੀਹ ਤਾਂ ਉਹਦੇ ਨਾਲ ਸਾਨੂੰ ਇੱਕ ਦੋ ਫ੍ਰੀ ਮਿਲ ਸਕਦੇ ਆ

ਬਈ ਇਹ ਵੀ ਮੈਨੂੰ ਦੱਸ ਦੇਣਾ ਕਿ ਮੈਂ ਟੇਬਲ ਦਾ ਖਰਚਾ ਕਿੰਨਾ ਕੁ ਆ ਕਿਉਂਕਿ ਅਸੀਂ ਪਹਿਲੀ ਵਾਰੀ ਕਰਾਇਆ ਨਾ ਸਾਨੂੰ ਕੁਛ ਪਤਾ ਨਹੀਂ ਹੈਗਾ ਅਤੇ ਮੈਨੂੰ ਦੱਸ ਦਿਓ ਕਿੰਨਾ ਕੁ ਖਰਚਾ ਆਵੇਗਾ ਅਤੇ ਕਿ ਕਿ ਉਹ ਸਾਨੂੰ ਕੁਰਚਾ ਬਰਗਰ ਜਿਵੇਂ ਵੀਹ ਪੱਚੀ ਲੈਂਦੇ ਤਾਂ ਸਾਨੂੰ ਉਹਦੇ ਨਾਲ ਇੱਕ ਦੋ ਫ੍ਰੀ ਮਿਲ ਸਕਦੇ ਆ ਪਲੀਜ਼ ਬਈ ਮੈਨੂੰ ਹੁਣੇ ਕਾਲ ਕਰਕੇ ਦੱਸ ਦਿਓ ਅਤੇ ਅਸੀਂ ਸ਼ਾਮ ਨੂੰ ਬਲਡੇ ਪਾਲਟੀ ਕਰਨੀ ਆ ਧੰਨਵਾਦ ਬਈ